ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਅਗਸਤ ਉੱਨੀ ਸੌ ਸੰਤਾਲ਼ੀ ਦੋ ਅਕਤੂਬਰ ਅਠਾਰਾਂ ਸੌ ਉਣੰਜਾ ਛੱਬੀ ਜਨਵਰੀ ਉੱਨੀ ਸੌ ਤ੍ਰਿਆਨਵੇਂ ਅਠਾਰਾਂ ਜਨਵਰੀ ਉੱਨੀ ਸੌ ਬਿਆਸੀ